ਸਤਿ ਸ਼੍ਰੀ ਅਕਾਲ ਜੀ ਪਾਲ ਢਾਬੇ ਤੋਂ ਬੋਲ ਰਹੇ ਆਂ ਮੈਂ ਮਟਰ ਪਨੀਰ ਮੰਗਵਾਇਆ ਸੀ ਤੁਹਾਡੇ ਕੋਲ਼ੋਂ ਪਰ ਤੁਸੀਂ ਗਲਤੀ ਨਾਲ ਦਾਲ ਮੱਖਣੀ ਭੇਜ ਦਿੱਤੀ ਹੈ ਜਿਸ ਦੀ ਕੁਆਲਿਟੀ ਬਹੁਤ ਹੀ ਬੇਕਾਰ ਹੈ ਅਤੇ ਤੁਸੀਂ ਨਾਲ ਰੋਟੀਆਂ ਵੀ ਭੇਜੀਆਂ ਹਨ ਅਤੇ ਉਹ ਵੀ ਬਹੀਆਂ ਹਨ ਅਤੇ ਮੇਰੀ ਤੁਹਾਡੇ ਕੋਲੋਂ ਇਹ ਬੇਨਤੀ ਹੈ ਕਿ ਮੈਨੂੰ ਜਾਂ ਤਾਂ ਰਿਫੰਡ ਕਰ ਦਿਉ ਜਾਂ ਤਾਂ ਘੱਟ ਦੇ ਘੱਟ ਸਮੇਂ ਵਿੱਚ ਜੋ ਮੈਂ ਮੰਗਵਾਇਆ ਸੀ ਮਟਰ ਪਨੀਰ ਉਹ ਮੈਨੂੰ ਭੇਜ ਦਿੱਤਾ ਜਾਵੇ